ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਸਭ ਵਧੀਆ ਅੱਛਾ ਅੱਛਾ ਜੀ ਹਾਂਜੀ ਜ਼ਰੂਰ ਦੱਸੋ ਜੀ ਹਾਂਜੀ ਹਾਂਜੀ ਅਤੇ ਤੁਸੀਂ ਕੋਈ ਜੀ ਸਕੈਨ ਵਗੈਰਾ ਕਰਵਾਈ ਸੀ ਜੀ ਅੱਛਾ ਜੀ ਸਕੈਨ ਕਿੱਥੋਂ ਕਰਵਾਈ ਸੀ ਜੀ ਅੱਛਾ ਇਹਨਾਂ ਨੂੰ ਕੋਈ ਹੋਰ ਪ੍ਰੋਬਲਮ ਹੈਗੀ ਆ ਜਿਵੇਂ ਗੁਰਦੇ 'ਚ ਪੱਥਰੀ ਜਾਂ ਸ਼ੂਗਰ ਬੀਪੀ ਵਗੈਰਾ ਅੱਛਾ ਇਹਨਾਂ ਦਾ ਕੋ ਅੱਛਾ ਇਹਨਾਂ ਨੇ ਪਹਿਲਾਂ ਤੋਂ ਕੋਈ ਦਵਾਈ ਲਈ ਹੈ ਜੀ ਕੋਈ ਪਹਿਲਾਂ ਓਪਰੇਸ਼ਨ ਵਗੈਰਾ ਤਾਂ ਨਹੀਂ ਹੋਇਆ ਹੋਇਆ ਅੱਛਾ ਵੈਸੇ ਤਾਂ ਇਹਦਾ ਪਿੱਤੇ ਦੀ ਪੱਥਰੀ ਦਾ ਵੀ ਕੋਈ ਵੀ ਇਲਾਜ ਨਹੀਂ ਹੁੰਦਾ ਅਤੇ ਇਹਦਾ ਓਪਰੇਸ਼ਨ ਹੀ ਕਰਵਾਉਣਾ ਪੈਂਦਾ ਹੁੰਦਾ ਵੈਸੇ ਤੁਸੀਂ ਕਿਹੜੇ ਡਾਕਟਰ ਤੋਂ ਦਵਾਈ ਲਈ ਸੀ ਪਹਿਲਾਂ ਅੱਛਾ ਤੁਸੀਂ ਇਹ ਨਾ ਦਰਦ ਦੀਆਂ ਗੋਲੀਆਂ ਨਾ ਖਾਇਆ ਕਰੋ ਇਹ ਤੋਂ ਇਲਾਵਾ ਤੁਸੀਂ ਪਰਹੇਜ਼ ਰੱਖਿਆ ਕਰੋ ਜ਼ਿਆਦਾ ਬੀਜਾਂ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਿਵੇਂ ਬੈਂਗਣ ਵਗੈਰਾ ਨਾ ਖਾਇਆ ਕਰੋ ਟਮਾਟਰ ਵਗੈਰਾ ਅਤੇ ਜੇ ਤੁਸੀਂ ਸਰਕਾਰੀ 'ਚ ਇਹ ਤਾਂ ਦੋ ਤਰ੍ਹਾਂ ਦਾ ਹੁੰਦਾ ਓਪਰੇਸ਼ਨ ਇੱਕ ਤਾਂ ਚੀਰੇ ਵਾਲਾ ਹੁੰਦਾ ਇੱਕ ਦੂਰਬੀਨ ਵਾਲਾ ਹੁੰਦਾ ਜਿਹੜਾ ਚੀਰੇ ਵਾਲਾ ਦੂਰਬੀਨ ਵਾਲੇ ਨਾਲ਼ੋਂ ਸਸਤਾ ਹੁੰਦਾ ਮਤਲਬ ਉਹ ਉੱਨੀ ਵੀਹ ਹਜ਼ਾਰ 'ਚ ਹੋ ਜਾਂਦਾ ਜਿਹੜਾ ਦੂਰਬੀਨ ਵਾਲਾ ਹੁੰਦਾ ਉਹ 'ਚ ਤੀਹ ਤੋਂ ਪੈਂਤੀ ਹਜ਼ਾਰ ਦਾ ਖਰਚਾ ਆ ਜਾਂਦਾ ਪ੍ਰਾਈਵੇਟ ਹੋਸਪੀਟਲ 'ਚ

ਠੀਕ ਹੈ ਜੀ ਓਕੇ